ਮੇਰੀ ਹ ਹਜੇ ਤੱਕ ਕੋਈ ਕਲਾ ਹੈ ਜੋ ਕਿ ਹਜੇ ਤੱਕ ਐਸੀ ਕੋਈ ਕਲਾ ਨਹੀਂ ਹੈ ਜੋ ਕਿ ਇੱਦਾਂ ਕਿਸੇ ਫੈਸ਼ਨ ਸ਼ੋਅ ਜਾਂ ਇਸ਼ਤਿਹਾਰਬਾਜੀ ਲਈ ਵਰਤੀ ਗਈ ਹੋਵੇ ਮਤਲਬ ਹਾਂ ਅਗਰ ਤੁਸੀਂ ਅੱਜ ਕੱਲ੍ਹ ਜੋ ਕਿ ਅਧਿਆਤਮਕ ਕਲਾ ਬਣ ਰਹੀ ਹੈ ਰੀਡਲ ਕਲਾ ਹੈ ਜੋ ਕਿ ਇਹ ਵੀ ਇੱਕ ਕਲਾ ਦਾ ਬਹੁਤ ਵੱਡਾ ਅੰਗ ਬਣ ਚੁੱਕਿਆ ਹੈ ਅੱਜ ਦੀ ਜ਼ਿੰਦਗੀ ਦੇ ਵਿੱਚ ਕਿਉਂਕਿ ਹਰ ਚੀਜ਼ ਡਿਜੀਟਲ ਹੋ ਰਹੀ ਹੈ ਤਾਂ ਕਲਾ ਦਾ ਵੀ ਉਹ ਮਾਧਿਅਮ ਹੈ ਜੋ ਕਿ ਡਿਜੀਟਲ ਆ ਚੁੱਕਿਆ ਹੈ ਤਾਂ ਮੈਂ ਕਾਫ਼ੀ ਸਾਰੇ ਸਾਡੀ ਇੱਕ ਆਰਕੀਟੈਕਚਰ ਦੇ ਵਿੱਚ ਇੱਕ ਸੰਸਥਾ ਹੈ ਜੋ ਕਿ ਬੱਚਿਆਂ ਦੀ ਹੀ ਬਣਾਈ ਹੋਈ ਸੰਸਥਾ ਹੈ ਬੱਚਿਆਂ ਦੇ ਲੀ ਹੀ ਲਈ ਹੀ ਸੰਸਥਾ ਉਹ ਬਣਾਈ ਗਈ ਹੈ ਜਿਸਨੂੰ ਨਾਸਾ ਇੰਡੀਆ ਕਿਹਾ ਜਾਂਦਾ ਹੈ ਤਾਂ ਉਸ ਦੇ ਵਿੱਚ ਮੈਂ ਬਤੋਰ ਡਿਜ਼ਾਈਨਰ ਦੋ ਸਾਲ ਕੰਮ ਕੀਤਾ ਹੈ ਤਾਂ ਉਸਦੇ ਵਿੱਚ ਮੇਰੀ ਕਾਫ਼ੀਆਂ ਕਲਾ ਹਨ ਜੋ ਕਿ ਉਨ੍ਹਾਂ ਦੀ ਸਾਲਾਨਾ ਸਰਾ ਰਸਾਲਾ ਸੀ ਉਸਦੇ ਵਿੱਚ ਵੀ ਛਪੀਆਂ ਹਨ ਅਤੇ ਜੋ ਮੇਰੇ ਕ ਕੁਛ ਕਲਾਵਾਂ ਹਨ ਜੋ ਕਿ ਉਹ ਉਨ੍ਹਾਂ ਦੇ ਜਿਹੜਾ ਉਨ੍ਹਾਂ ਦਾ ਇੰਸਟਾਗ੍ਰਾਮ ਦੇ ਉੱਤੇ ਪੇਜ ਹੈ ਉਸਦੇ ਉੱਤੇ ਵੀ ਉਨ੍ਹਾਂ ਨੇ ਦਰਜ ਕੀਤੀਆਂ ਹਨ ਅਤੇ ਬਹੁਤ ਸਾਡੇ ਇਸ਼ਤਿਹਾਰ ਹਨ ਜਿਨ੍ਹਾਂ ਦੇ ਵਿੱਚ ਉਨ੍ਹਾਂ ਨੇ ਜੋ ਕਿ ਮੇਰੇ ਦੁਆਰਾ ਬਣਾਏ ਗਏ ਹਨ ਅਤੇ ਬਾਕੀ ਸਾਡੇ ਸਕੂਲ ਦੇ ਵਿੱਚ ਗਿਆਰਵੀਂ ਬਾਰਵੀਂ ਜਿੱਥੋਂ ਮੈਂ ਕੀਤੀ ਹੈ ਉਸਦੇ ਵਿੱਚ ਕਲਾ ਦੇ ਮੁਕਾਬਲੇ ਹੁੰਦੇ ਸਨ ਅਤੇ ਉਨ੍ਹਾਂ ਮੁਕਾਬਲਿਆਂ ਦੇ ਵਿੱਚ ਵੀ ਮੈਂ ਹਿੱਸਾ ਲਿਆ ਹੈ ਤਾਂ ਉੱਥੇ ਵੀ ਤੁਸੀਂ ਕਹਿ ਸਕਦੇ ਹੋ ਕਿ ਵੀ ਉੱਥੇ ਜਿੱਥੇ ਮੇਰੀ ਕਲਾ ਦਾ ਦਿਖਾਈ ਗਈ ਹੈ ਅਤੇ ਹਾਂ ਸਾਡੀ ਸਕੂਲ ਦੇ ਵਿੱਚ ਇੱਕ ਸਲਾਨਾ ਪ੍ਰੋਗਰਾਮ ਹੁੰਦਾ ਹੈ ਜੋ ਸਕੂਲ ਦਾ ਸਾਲਾਨਾ ਪ੍ਰੋਗਰਾਮ ਹੁੰਦਾ ਹੈ ਅਤੇ ਉਸਦੇ ਜਿਸਨੂੰ ਫਾਊਂਡਰਸ ਡੇਅ ਕਹਿੰਦੇ ਹਨ ਸਾਡਾ ਸਕੂਲ ਦਾ ਜਿਹੜਾ ਉਹ ਸਾਲਾਨਾ ਪ੍ਰੋਗਰਾਮ ਸੀ ਤਾਂ ਉਹ ਫਾਊਂਡਰਸ ਡੇਅ ਵਾਲੇ ਦਿਨ ਉਸ ਦਿਨ ਜਿਹੜੇ ਰਾਊਂਡ 'ਤੇ ਆਉਂਦੇ ਸਨ ਆਰਮੀ ਸਕੂਲ ਹੋਣ ਦੇ ਕਾਰਨ ਤਾਂ ਫੌਜ ਦੇ ਵੱਡੇ ਵੱਡੇ ਜਿਹੜੇ ਅਹੁਦੇ ਵਾਲੇ ਔਫ਼ੀਸਰ ਹਨ ਅਫ਼ਸਰ ਉਹ ਆਉਂਦੇ ਸਨ ਤਾਂ ਉਨ੍ਹਾਂ ਅਫ਼ਸਰਾਂ ਨੇ ਮੇਰੀ ਕਲਾ ਨੂੰ ਬਹੁਤ ਪ੍ਰਸ਼ੰਸਾ ਕੀਤੀ ਸੀ ਮੇਰੀ ਦੋ ਤਿੰਨ ਕਲਾਵਾਂ ਹਨ ਜਿਹੜੀਆਂ ਕਿ ਉਹ ਸਾਡੇ ਉੱਥੇ ਹੋਲ ਦੇ ਵਿੱਚ ਲਗਾਈਆਂ ਗਈਆਂ ਸਨ ਇਸ ਤੋਂ ਇਲਾਵਾ ਕੋਈ ਇੱਦਾਂ ਵੱਡੇ ਪੱਧਰ ਦੇ ਉੱਤੇ ਹਜੇ ਤੱਕ ਜੋ ਕਲਾ ਦਾ ਪ੍ਰਯੋਗ ਨਹੀਂ ਹੋਇਆ ਹੈ